ਹਾਂਜੀ ਨਮਸਤੇ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਇਹ ਹੁਣ ਜਦੋਂ ਦੱਸਣੀ ਦੱਸਿਆ ਜਾਂਦਾ ਹੈ ਕਿ ਜਦੋਂ ਕਿ ਪਿੰਡ ਵਿੱਚ ਗਰੀਬੀ ਹੋਵੇ ਤਾਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਹਰ ਘਰ ਗਰੀਬ ਹੀ ਹੁੰਦਾ ਹੈ ਕੋਈ ਹੈ ਕਿ ਜੋ ਮਤਲਬ ਠੀਕ ਠਾਕ ਹੁੰਦੇ ਹਨ ਜਦੋਂ ਵੀ ਕਿਸੇ ਗਰੀਬ ਨੂੰ ਐਕਸੀਡੈਂਟ ਹੋ ਜਾਏਗਾ ਕੋਈ ਗਰੀਬ ਬੀਮਾਰ ਹੋ ਜਾਵੇ ਤਾਂ ਉਸਨੂੰ ਡਾਕਟਰ ਕੋਲ ਲਿਜਾਣਾ ਜ ਪੈਂਦਾ ਹੈ ਅਤੇ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਾਂਦਾ ਹੈ ਜਦੋਂ ਕਿ ਅਸੀਂ ਕਿਸੇ ਐਬੂਲੈਂਸ ਨੂੰ ਫੋਨ ਕਰਦੇ ਹਾਂ ਅਤੇ ਉਹ ਵੀ ਟਾਈਮ ਦੀ ਨਹੀਂ ਆਉਂਦੀ ਜਦੋਂ ਆ ਵੀ ਜਾਏ ਤਾਂ ਹੋਸਪੀਟਲ ਪੁਜਾਇਆ ਜਾਂਦਾ ਹੈ ਅਤੇ ਉੱਥੇ ਜਾ ਕੇ ਕੀ ਜੋ ਕਿ ਦਵਾਈਆਂ ਦੀ ਸੇਵਾਵਾਂ ਮਿਲ ਜਾਂਦੀਆਂ ਹਨ ਅਤੇ ਡੋਕਟਰ ਨਹੀਂ ਹੁੰਦੇ ਹੈਗੇ ਡੋਕਟਰ ਹੋਣ 'ਤੇ ਪੇਸੈਂਟ ਨੂੰ ਦਵਾਈਆਂ ਹੀ ਨਹੀਂ ਟਾਈਮ ਦੀਆਂ ਦਿੱਤੀਆਂ ਜਾਂਦੀਆਂ ਹਨ ਇਸ ਕਰਕੇ ਕਿ ਗਰੀਬਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਮਤਲਬ ਕਿ ਹੁਣ ਤਾਂ ਹਰ ਜਗ੍ਹਾ ਬਹੁਤ ਫੈਸਿਲਿਟੀ ਹੈ ਕਿ ਜਦੋਂ ਐਬੂਲੈਂਸ ਨੂੰ ਫੋਨ ਕਰੋ ਅਤੇ ਐਬੂਲੈਂਸਾਂ ਵੀ ਕਈ ਵਾਰ ਨਹੀਂ ਆਉਂਦੀਆਂ ਕਈ ਵਾਰੀ ਤਾਂ ਆ ਜਾਂਦੀਆਂ ਹਨ ਇਸ ਕਰਕੇ ਗਰੀਬਾਂ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਹਰ ਗਰੀਬ ਨੂੰ ਬਿਮਾਰ ਹੋਣ 'ਤੇ ਜਾਂ ਐਕਸੀਡੈਂਟ ਹੋਣ 'ਤੇ ਹਰ ਦਿੱਤੀ ਜਾਵੇ ਤਾਂ ਕਿ ਉਸਦੀ ਜਾਨ ਨੂੰ ਬਚਾਇਆ ਜਾਵੇ ਧੰਨਵਾਦ